ਅਸੀਂ ਰੇਡੀਓ ਸੁਣਨਾ ਬਹੁਤ ਪਸੰਦ ਕਰਦੇ ਹਾਂ ਜਦੋਂ ਪਹਿਲਾਂ ਦੇ ਟਾਈਮ ਵਿੱਚ ਟੀ ਵੀ ਨਹੀਂ ਹੁੰਦੇ ਸਨ ਤਾਂ ਵੀ ਅਸੀਂ ਰੇਡੀਓ ਦੀਆਂ ਹੀ ਖਬਰਾਂ ਸੁਣਦੇ ਸੀ ਇਸ ਟਾਈਮ ਵੀ ਅਸੀਂ ਚੈਨਲ ਨੰਬਰ ਨਾਈਨਟੀ ਫਾਈਵ ਐੱਫ ਐੱਮ ਵੰਨ ਜੀਰੋ ਫਾਈਵ ਐੱਫ ਐੱਮ 'ਤੇ ਸੁਣਦੇ ਹਾਂ ਖਬਰਾਂ ਸੁਣਨ ਨੂੰ ਸ਼ਾਮ ਨੂੰ ਅਸੀਂ ਛੇ ਵਜੇ ਸਾਰਾ ਦਿਨ ਸੁਣਦੇ ਹਾਂ ਵੈਸੇ ਤਾਂ ਸ਼ਾਮ ਨੂੰ ਛੇ ਵਜੇ ਫਿਰ ਅਸੀਂ ਖਬਰਾਂ ਸੁਣਦੇ ਸਾਰੀ ਫੈਮਿਲੀ ਬੈਠ ਕੇ ਇਕੱਠੇ ਸੁਣਦੇ ਹਾਂ